ਹਾਂਜੀ ਸਰ ਕੀ ਹਾਲ ਜੇ ਬਹੁਤ ਵਧੀਆ ਸਰ ਸਰ ਐਕਚੁਲੀ ਤੁਹਾਡਾ ਨੰਬਰ ਨਾ ਗੂਗਲ ਤੋਂ ਸਰਚ ਕੀਤਾ ਸੀਗਾ ਟੂਰ ਐਂਡ ਟਰੈਵਲ ਦੇ ਰਿਗਾਰਡਿੰਗਲੀ ਸੰਜੇ ਭਾਅ ਜੀ ਗੱਲ ਕਰ ਰਹੇ ਹੋ ਹਾਂਜੀ ਭਾਅ ਜੀ ਭਾਅ ਜੀ ਐਕਚੁਲੀ ਮੈਂ ਨਾ ਪੰਜਾਬ ਟੂਰ ਕਰਨਾ ਸੀਗਾ ਥੋੜ੍ਹਾ ਜਿਹਾ ਅਤੇ ਉਹਦੇ ਰਿਗਾਰਡਿੰਗਲੀ ਵੋਲਵੋ ਦੇ ਰਿਗਾਰਡਿੰਗਲੀ ਥੋੜ੍ਹੀ ਇਨਫੋਰਮੇਸ਼ਨ ਲੈਣੀ ਸੀਗਾ ਕਿ ਵੋਲਵੋ ਸਰ ਆਪਣੀ ਸਾਰੇ ਬੰਨੇ ਅਵੇਲੇਬਲ ਰਹੇਗੀ ਨਾ ਵੋਲਵੋ ਸਰ ਜਿਹੜੀ ਮੇਰੀ ਪਿਓਰਿਟੀ ਆ ਨਾ ਉਹ ਮੇਰੀ ਲਾਈਕ ਚੰਡੀਗੜ੍ਹ ਫਰੀਦਕੋਟ ਬਠਿੰਡਾ ਜਾਂ ਜੰਮੂ ਵੱਲ ਦੀ ਰਹੇਗੀ ਪੋਸੀਬਿਲਿਟੀ ਹੈਗੀ ਸਰ ਆਪਣੇ ਵੋਲਵੋ ਦੀ ਠੀਕ ਹੈ ਸਰ ਠੀਕ ਹੈ ਐਂਡ ਸਰ ਸਲਿਪਰ ਦੋਵੇਂ ਬ ਬੋਥ ਟਾਈਪ ਅਵੇਲੇਬਲ ਹੈ ਨਾ ਸਿੰਗਲ ਐਂਡ ਡਬਲ ਠੀਕ ਹੈ ਠੀਕ ਹੈ ਫਿਰ ਚਾਰਜਿਜ ਸਰ ਸੇਮ ਰਹਿਣਗੇ ਦੋਵਾਂ ਦੇ ਅਗਰ ਮੈਂ ਸਿੰਗਲ ਵੀ ਕਰਵਾਵਾਂ

ਨਹੀਂ ਨਹੀਂ ਅਸਲ ਪਤਾ ਨਹੀਂ ਐਕਚੁਲੀ ਸਿੰਗਲ ਵੀ ਲੈ ਸਕਦਾ ਅਗਰ ਮੇਰੇ ਨਾਲ ਕੋਈ ਮੇਰਾ ਕਲੀਗ ਮੰਨ ਗਿਆ ਜਾਂ ਮਿਲ ਗਿਆ ਦੈਨ ਮੈਂ ਸ਼ੇਅਰਿੰਗ ਵਿੱਚ ਵੀ ਲੈ ਸਕਦਾ ਚਲੋ ਠੀਕ ਹੈ ਸਰ ਠੀਕ ਹੈ ਐਂਡ ਸਰ ਚ ਅਗਰ ਮੈਂ ਬੁਕਿੰਗ ਕਰਵਾਉਣੀ ਹੋਵੇ ਤਾਂ ਕਿੰਨੇ ਡੇਸ ਪਹਿਲਾਂ ਕਰਵਾ ਸਕਦਾ ਮੈਂ ਸੇਮ ਡੇ ਹੋ ਜਾਵੇਗੀ ਬੁਕਿੰਗ ਚਲੋ ਠੀਕ ਹੈ ਸਰ ਠੀਕ ਹੈ ਬਾਕੀ ਸਰ ਮੇਰਾ ਪਲੈਨ ਬਣਦਾ ਦੈਨ ਸਰ ਮੈਂ ਤੁਹਾਨੂੰ ਇਨਫੋਰਮ ਕਰਦਾ ਦੈਨ ਪਹਿਲਾਂ ਹੀ ਬੁਕਿੰਗ ਕਰਵਾ ਲਾਂਗਾ ਚਲੋ ਠੀਕ ਹੈ ਥੈਂਕ ਯੂ ਸੋ ਮਚ ਸਰ